ਹੈਲੋ ਕੌਣ ਬੋਲਦਾ ਅੱਛਾ ਅਸੀਂ ਨਾ ਬਾਈ ਜੀ ਭਾ ਭਾਂਡੇ ਲੈਣੇ ਆ ਵੱਡੇ ਹਲਵਾਈਆਂ ਵਾਲੇ ਅਤੇ ਆਪਣੇ ਕੋਲੋਂ ਮਿਲ ਜਾਣਗੇ ਸਾਨੂੰ ਘੱਟੋ ਘੱਟ ਜਿਹਦੇ ਵਿੱਚ ਪੰਜ ਦਸ ਦਸ ਕਿਲੋ ਸਬਜ਼ੀ ਬਣ ਜਾਵੇ ਪਤੀਲੇ ਵੀਹ ਕਿਲੋ ਦਾਲ ਬਣ ਜਾਵੇ ਦੇਗ ਵੀਹ ਕਿਲੋ ਦਾਲ ਦੀ ਦੇਗ ਅਤੇ ਪਰਾਤਾਂ ਚਾਹੀਦੀਆਂ ਜਿਹਦੇ 'ਚ ਆਟਾ ਕੋਈ ਪੰਜ ਸੱਤ ਕਿਲੋ ਇੱਕ ਵਾਰੀ ਗੁਝ ਜਾਵੇ ਪੰਜ ਪੰਜ ਪਤੀਲੇ ਚਾਹੀਦੇ ਆ ਪੰਜ ਦੋ ਦੇਗਾਂ ਚਾਹੀਦੀਆਂ ਅਤੇ ਦੋ ਪਰਾਤਾਂ ਚਾਹੀਦੀਆਂ ਵੱਡੀਆਂ ਹਾਂ ਖੁਰਚਣੇ ਵੀ ਲੈਣੇ ਆ ਨਾਲ ਖੁਰਚਣੇ ਹੋਣਗੇ ਅਤੇ ਟੱਬ ਵੀ ਚਾਹੀਦੇ ਆ ਦੋ ਤਿੰਨ ਟੱਬ ਹੋ ਜਾਣਗੇ ਇਹ ਆਪਾਂ ਨੂੰ ਅਤੇ ਮਤਲਬ ਇਹ ਕਿੰਨੀ ਕੁ ਰੇਂਜ 'ਚ ਕੀ ਹਿਸਾਬ 'ਤੇ ਤੋਲ ਕੇ ਦਿਓਗੇ ਕੀ ਉਂਝ ਅ ਇੱਕ ਚੀਜ਼ ਦਾ ਰੇਟ ਹੋਵੇਗਾ ਅੱਛਾ ਪਰਾਤਾਂ ਵੀ ਕਿਸ ਕਿਸ ਕਰਕੇ ਚੀਜ਼ ਵਿੱਚ ਹੋਣਗੇ ਇਹ ਆਪਣੇ ਲੋਹ ਉਹਦੇ 'ਚ ਜਿਸਤੀ ਵਿੱਚ ਕਿ ਪਿੱਤਲ 'ਚ ਹੈਂ ਅੱਛਾ ਅਤੇ ਉਹ ਦੇਗ ਜਿਹੜੀ ਦੇਗ ਕਾਹਦੀ ਹੋਵੇਗੀ ਠੀਕ ਆ ਅਤੇ ਚਲੋ ਅਤੇ ਇਹ ਮਤਲਬ ਆਪਣੀ ਦੁਕਾਨ ਹੈ ਕਿੱਥੇ ਕੁ ਜੇ ਪੈ ਜਾਂਦੀ ਆ ਠੀਕ ਕੀ ਨਾਂ ਦੁਕਾਨ ਦਾ ਹਾਂ ਠੀਕ ਆ ਤੁਸੀਂ ਆਪਦਾ ਕਾਰਡ ਮੈਨੂੰ ਅ ਤੁਸੀਂ ਫੋਨ ਕਰਦੇ ਹੋ ਤੁਹਾਨੂੰ ਨੰਬਰ ਤਾਂ ਨੰਬਰ ਲ ਆ ਗਿਆ ਤੁਹਾਡਾ ਅਤੇ ਸਾਨੂੰ ਕਾਟ ਲੈ ਲਵਾਂਗੇ ਤੁਹਾਡੇ ਕੋਲੋਂ ਤਾਂ ਵੀ ਤੁਹਾਡਾ ਹੋਊਗਾ ਉਹ ਉਹ ਲੈ ਕੇ ਅਤੇ ਫਿਰ ਨਾਲ ਸਲਾਹ ਕਰਕੇ ਅਤੇ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਅਤੇ ਹੁਣ ਹਾਂ ਅਤੇ ਮਤਲਬ ਤਾਂ ਕਿੰਨੇ ਕਿ ਜੇ ਬਣਵਾ ਕੇ ਦਿਓ ਕਿ ਬਣੇ ਬਣਾਏ ਤੁਹਾਡੇ ਕੋਲ ਹੁੰਦੇ ਆ ਠੀਕ ਆ ਚਲੋ ਠੀਕ ਆ ਫਿਰ ਹੋਰ ਕੋਈ ਮਤਲਬ ਕਿ ਹੋਰ ਭਾਂਡੇ ਕੀ ਕੀ ਹੋਣਗੇ ਤੁਹਾਡੇ ਕੋਲੇ ਦੂਜੇ ਛੋਟੇ ਵੀ ਹੋਣਗੇ ਥਾਲ ਹਾਂ ਥਾਲ ਅਤੇ ਵਗੈਰਾ ਅਤੇ ਬਾਕੀ ਉਹ ਜਿਹੜੇ ਕੋਲੀਆਂ ਜਿਹੇ ਥਾਲ ਹੁੰਦੇ ਇੱਕ ਤਾਂ ਕੜਛੀਆਂ ਸੱਚ ਕੜਛੀਆਂ ਵੀ ਚਾਹੀਦੀਆਂ ਖੁਰਚਣੇ ਕੜਛੀਆਂ ਅਤੇ ਇੱਕ ਦਾਲ ਪਾਉਣ ਵਾਲੇ ਹੁੰਦੇ ਆ ਨਾ ਆਪਣੇ ਹਾਂ ਦਾਲ ਵਰਤਾਉਣ ਵਾਲੇ ਜਿਹੜੇ ਹੁੰਦੇ ਉਹ ਵੀ ਚਾਹੀਦੇ ਆ ਹਾਂ ਅਤੇ ਬਾ ਬਾਲਟੀਆਂ ਵੀ ਚਾਹੀਦੀਆਂ ਨਾਲ ਅਤੇ ਠੀਕ ਹੈ ਚਲੋ ਫਿਰ ਅਸੀਂ ਹਾਂ ਫਿਰ ਅਸੀਂ ਕੱਲ੍ਹ ਨੂੰ ਆਵਾਂਗੇ ਤੁਹਾਡੇ ਕੋਲੇ ਆ ਕੇ ਅਤੇ ਫਿਰ ਨਾਲ ਦੇਖ ਆਵਾਂਗੇ ਠੀਕ ਆ ਜੀ ਸਤਿ ਸ਼੍ਰੀ ਅਕਾਲ